ਆਈ ਆਈ ਟੀ ਆਈ ਆਈ ਟੀ ਐਸ ਈ ਅਤੇ ਆਈ ਆਈ ਟੀ ਸੀ ਸਭ ਤੋਂ ਵੱਡੀ ਸਿੱਖਿਆ ਹੁੰਦੀ ਹੈ ਇਸ ਵਿੱਚ ਗਰੀਬ ਲੋਕ ਪੜ੍ਹ ਨਹੀਂ ਸਕਦੇ ਇਸ ਵਿੱਚ ਅਮੀਰ ਲੋਕ ਹੀ ਪੜ੍ਹ ਸਕਦੇ ਹਨ ਔਰ ਇਸ ਵਿੱਚ ਬਹੁਤ ਹੀ ਵਧੀਆ ਸਿੱਖਿਆ ਮਿਲੀ ਜਾਂਦੀ ਹੈ ਤਾਂ ਕਰਕੇ ਤਾਂ ਕਰਕੇ ਇਹਨਾਂ ਨੂੰ ਵਧੀਆ ਜਿਹੀ ਨੌਕਰੀ ਮਿਲ ਜਾਂਦੀ ਹੈ ਅਤੇ ਇਹ ਵੱਡੇ ਲੋਕ ਬਣ ਜਾਂਦੇ ਹਨ ਜਿਹੜੇ ਗਰੀਬ ਹੁੰਦੇ ਹਨ ਉਹ ਇਸ ਵਿੱਚ ਐਂਟਰੀ ਨਹੀਂ ਹੋ ਸਕਦੇ ਹਨ ਕਿਉਂਕਿ ਇਸ ਵਿੱਚ ਬਹੁਤ ਹੀ ਪੈਸੇ ਖਰਚ ਹੁੰਦੇ ਹਨ ਇਹ ਬਹੁਤ ਹੀ ਵੱਡਾ ਹੈ ਸਕੂਲ ਹੈ ਦਿੱਲੀ ਵਿੱਚ ਬੱਚਿਆਂ ਦਾ ਟੈਸਟ ਲਿਆ ਜਾਂਦਾ ਹੈ ਜਿਸ ਵਿੱਚ ਦਸ ਹੀ ਲੋਕ ਦਸ ਲੋਕ ਚੁਣੇ ਜਾਂਦੇ ਹਨ ਸਕੂਲ ਵਿੱਚ ਬਹੁਤ ਹੀ ਘੰਟਿਆਂ ਤੱਕ ਪੜ੍ਹਾਈ ਹੁੰਦੀ ਹੈ ਅਤੇ ਬਹੁਤ ਹੀ ਵਧੀਆ ਪੜ੍ਹਾਈ ਹੁੰਦੀ ਹੈ